ਯੋਗਾ ਵਿੱਚ ਸਭ ਤੋਂ ਪਸੰਦੀਦਾ ਮੇਰਾ ਕਪਾਲ ਭਾਤੀ ਕਪਾਲ ਭਾਤੀ ਬਹੁਤ ਵਧੀਆ ਵਾ ਸਭ ਤੋਂ ਵਧੀਆ ਹਰ ਇੱਕ ਨੂੰ ਕਰਨਾ ਚਾਹੀਦਾ ਇੱਕ ਤਾਂ ਮੋਟਾਪਾ ਨਹੀਂ ਹੋਣ ਦਿੰਦਾ ਕਪਾਲ ਭਾਤੀ ਦੂਜਾ ਜਿਹੜਾ ਸਰੀਰ ਦੇ ਵਿੱਚ ਜਿਵੇਂ ਆਪਾਂ ਐਕਸਰਸਾਈਜ਼ ਕਰਦੇ ਹਾਂ ਕੋਈ ਵਰਜੀਸ਼ ਕਰਦੇ ਹਾਂ ਜਿਹੜਾ ਫਾਲਤੂ ਹੁੰਦਾ ਸ ਮਟੀਰੀਅਲ ਜਿਹੜਾ ਸਾਡੇ ਸਰੀਰ ਦਾ ਉਹ ਸਾਰਾ ਬਾਹਰ ਨਿਕਲ ਜਾਂਦਾ ਜਦੋਂ ਆਪਾਂ ਬਾਥਰੂਮ ਕਰਦੇ ਹਾਂ ਕਪਾਲ ਭਾਤੀ ਬਹੁਤ ਵਧੀਆ ਇੱਕ ਤਾਂ ਮੋ ਮੋਟਾਪਾ ਨਹੀਂ ਹੋਣ ਦਿੰਦਾ ਦੂਜਾ ਬਿਮਾਰੀ ਨਹੀਂ ਲਾਗੇ ਲੱਗਣ ਦਿੰਦਾ ਕਿਸੇ ਤਰ੍ਹਾਂ ਦੀ ਇਹ ਸਾਨੂੰ ਕਪਾ ਮੇਰਾ ਕਪਾਲ ਭਾਤੀ ਸਭ ਤੋਂ ਬੈਸਟ ਆ